ਹੈਲੋ ਹਾਂਜੀ ਭਾਈ ਸਾਹਿਬ ਤੁਸੀਂ ਇਲੈਕਟ੍ਰੀਸ਼ਨ ਬੋਲ ਰਹੇ ਹੋ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਅਸੀਂ ਨਾ ਨਵੀਂ ਕੋਠੀ ਬਣਾਈ ਸੀਗੀ ਅਤੇ ਕੋਠੀ ਦੇ ਸਾਰੀ ਬਿਜਲੀ ਦੀ ਫਿਟਿੰਗ ਕਰਵਾਉਣੀ ਸੀ ਤੁਸੀਂ ਮੈਨੂੰ ਦੱਸੋਗੇ ਕਿਸ ਤਰ੍ਹਾਂ ਦਾ ਮਤਲਵ ਫਿਟਿੰਗ ਕਰਦੇ ਹੋ ਕੰਮ ਉਹ ਕਿਵੇਂ ਕਰਦੇ ਹੋ ਅੰਡਰਗਰਾਊਂਡ ਕਰਦੇ ਹੋ ਜਾਂ ਬਾਹਰ ਵੀ ਕਰ ਦਿੰਦੇ ਹੋ ਸਾਰਾ ਨਹੀਂ ਭਾਈ ਸਾਹਿਬ ਆਪਾਂ ਕੰਮ ਇਵੇਂ ਕਰਨਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਕਰੰਟ ਨਾ ਆਵੇ ਵੀ ਬੱਚੇ ਛੋਟੇ ਨੇ ਘਰ ਦੇ ਵਿੱਚ ਅਤੇ ਅੰਡਰਗਰਾਊਂਡ ਤਾਂ ਜਿਹੜੀ ਆਪਾਂ ਜਿੱਥੇ ਜਿੱਥੇ ਅੰਡਰ ਆਪਾਂ ਗਰਾਊਂਡ ਪਾਈਪਾਂ ਪਾਈਆਂ ਹੋਈਆਂ ਨੇ ਉੱਥੇ ਵੀ ਬਿਜਲੀ ਦੀ ਫੀਟਿੰਗ ਹੋ ਜਾਵੇਗੀ ਨਹੀਂ ਜੀ ਭਾਈ ਸਾਹਿਬ ਸਮਾਨ ਤੁਸੀਂ ਨਹੀਂ ਲੈ ਕੇ ਆਓਗੇ ਆਪੇ ਹੀ ਆਪਣੀ ਦੁਕਾਨ 'ਤੇ ਆਪਣੀ ਨਹੀਂ ਭਾਈ ਸਾਹਿਬ ਭਾਈ ਸਾਹਿਬ ਵੀਹ ਬਾਈ ਸੱਤਰ ਹੈਗਾ ਆਪਣਾ ਮਕਾਨ

ਥੱਲੇ ਸਾਡੇ ਕੋਲ ਦੋ ਕਮਰੇ ਹੈ ਤੇ ਹਾਂਜੀ ਹਾਂਜੀ ਸਟੋਰ ਵੀ ਹੈਗਾ ਫਲੱਸ਼ ਹੈ ਬਾਥਰੂਮ ਹੈ ਅਤੇ ਆਪਾਂ ਬਿਜਲੀ ਦਾ ਕੰਮ ਸਾਰੇ ਪਾਸੇ ਹੀ ਕਰਨਾ ਫਲੱਸ਼ ਬਾਥਰੂਮ 'ਚ ਵੀ ਲਾਈਟ ਚਾਹੀਦੇ ਪੱਖਾ ਵੀ ਚਾਹੀਦਾ ਹੈ ਸਟੋਰ 'ਚ ਵੀ ਹੈਗਾ ਲਾਈਟ ਪੱਖਾ ਅਤੇ ਜ਼ਿਆਦਾ ਤਾਂ ਆਪਣਾ ਹਾਂਜੀ ਤਾਂ ਤੁਸੀਂ ਨਾ ਮਤਲਬ ਕੰਮ ਆਪਾਂ ਇਵੇਂ ਕਰਨਾ ਜਿਵੇਂ ਜਿੱਥੇ ਜਿੱਥੇ ਆਪਣੇ ਅੰਡਰਗਰਾਊਂਡ ਕੰਮ ਹੋਇਆ ਹੋਇਆ ਪਾਈਪਾਂ ਪਾਈਆਂ ਹੋਈਆਂ ਹੈ ਉਹ ਸਾਰਾ ਕੰਮ ਅੰਡਰਗਰਾਉਂਡ ਰਹੇਗਾ ਪਰ ਜਿਹਦੇ ਸਾਨੂੰ ਪਿੱਛੇ ਰਹਿ ਗਿਆ ਸਾਡਾ ਪਾਉਣਾ ਅੰਡਰਗਰਾਊਂਡ ਪਾਈਪਸ ਅਤੇ ਉਹਨਾਂ ਦਾ ਜਿਹੜਾ ਕੰਮ ਹੈ ਤੁਸੀਂ ਉਹ ਪਾਈਪਾਂ ਬਾਹਰ ਪਾਓਗੇ ਕਿ ਫਿਰ ਉਹ ਝੀਰੀ ਲਗਾਓਗੇ ਮਤਲਬ ਕੱਟ ਮਾਰੋਗੇ ਅੱਛਾ ਉਹ ਮਜ਼ਦੂਰ ਤੁਹਾਡਾ ਹੋਵੇਗਾ ਨਾਲ ਠੀਕ ਹੈ ਅਤੇ ਅੱਛਾ ਅਤੇ ਭਾਈ ਸਾਹਿਬ ਸਾਰਾ ਸਮਾਨ ਆਪਣੀ ਖੁਦ ਦੀ ਦੁਕਾਨ 'ਤੇ ਨਹੀਂ ਹੋਵੇਗਾ ਕਿ ਸਾਰਾ ਬਾਜ਼ਾਰੋਂ ਲਿਆਉਣਾ ਪਵੇਗਾ ਆਪਾਂ ਨੂੰ ਲਿਆਉਣਾ ਅੱਛਾ ਫਿਰ ਵੀ ਮੈਨੂੰ ਤੁਸੀਂ ਮੈਨੂੰ ਜਿਵੇਂ ਤਾਂ ਮੈਂ ਘਰ ਦਾ ਏਰੀਆ ਦੱਸਿਆ ਵੀਹ ਬਾਈਏ ਸੱਤਰ ਅਤੇ ਥੋੜ੍ਹਾ ਅਲਟੀਮੇਟ ਦੱਸ ਸਕਦੇ ਹੋ ਵੀ ਕਿੰਨਾ ਕੁ ਖਰਚਾ ਆਪਣਾ ਆ ਜਾਵੇਗਾ ਹਾਂਜੀ ਭਾਈ ਸਾਹਿਬ ਸਮਾਨ ਦਾ ਚਲੋ ਖਰਚਾ ਤਾਂ ਮੈਂ ਅਲੱਗ ਤੋਂ ਹੈ ਪਰ ਤੁਹਾਡੀ ਲੇਬਰ ਕੀ ਰਹੇਗੀ

ਅੱਛਾ ਅੱਛਾ ਠੀਕ ਹੈ ਠੀਕ ਹੈ ਭਾਈ ਸਾਹਿਬ ਠੀਕ ਹੈ ਅਤੇ ਹਾਂਜੀ ਚਲੋ ਫਿਰ ਜਦੋਂ ਅਸੀਂ ਕਰਵਾਉਂਦੇ ਆ ਤੁਹਾਨੂੰ ਸੇਵਾ ਦਾ ਮੌਕਾ ਜ਼ਰੂਰ ਦੇਵਾਂਗੇ ਠੀਕ ਹੈ ਭਾਈ ਸਾਹਿਬ ਠੀਕ